ਹੈਲੋ ਹਾਂਜੀ ਹਾਂਜੀ ਪਲੰਬਰ ਬੋਲ ਰਿਹਾ ਜੀ ਹਾਂਜੀ ਹਾਂਜੀ

ਹਾਂਜੀ ਹਾਂਜੀ ਸਰ ਪਹਿਲਾਂ ਤੁਸੀਂ ਫਿਟਿੰਗ ਸਾਡੇ ਤੋਂ ਹੀ ਕਰਵਾਈ ਹੈ ਸਰ ਅੱਛਾ ਅੱਛਾ ਜੀ ਠੀਕ ਹੈ ਜੀ ਠੀਕ ਹੈ ਸਰ ਸਰ ਸਰ ਹੁਣ ਤਾਂ ਥੋੜ੍ਹਾ ਟੈਮ ਹੈ ਨਹੀਂ ਸਾਨੂੰ ਅਤੇ ਅ ਹੁਣ ਤੁਸੀਂ ਸਵੇਰ ਦੇ ਦਸ ਵਜੇ ਸਰ ਸ਼ਾਮ ਤੱਕ ਕਰ ਦਾਂਗੇ ਸਰ ਛੇ ਵਜੇ ਤੱਕ ਹਾਂਜੀ ਹਾਂਜੀ ਸ਼ਾਮ ਤੱਕ ਪੱਕਾ ਨਹੀਂ ਕਹਿ ਸਕਦੇ ਸਰ ਕਿਉਂਕਿ ਕੱਲ੍ਹ ਦਾ ਦਿਨ ਵੀ ਹੋ ਸਕਦਾ ਕਿਉਂਕਿ ਸਾਡੇ ਕੋਲ ਅਜੇ ਕੰਮ ਬਹੁਤ ਪਿਆ ਸਰ ਹਾਂਜੀ ਸਰ ਅਸੀਂ ਅਡਜਸਟ ਕਰਕੇ ਵੇਖਾਂਗੇ ਅਗਰ ਹੋ ਸਕਿਆ ਤਾਂ ਕਰ ਦਾਂਗੇ ਸਰ ਤੁਹਾਨੂੰ ਤੁਹਾਨੂੰ ਪੱਕਾ ਨਹੀਂ ਕਹਿ ਸਕਦੇ ਵੀ ਅੱਜ ਹੀ ਹੋਜੂਗਾ ਬਾਕੀ ਕੱਲ੍ਹ ਦੀ ਦਿਹਾੜੀ 'ਚ ਤੁਹਾਨੂੰ ਪੱਕਾ ਕਰ ਦਾਂਗੇ ਸਰ ਸਰ ਉਹ ਤਾਂ ਤੁਹਾਡੀ ਮਜਬੂਰੀ ਹਾਂਜੀ ਹਾਂਜੀ ਉਹ ਤਾਂ ਤੁਹਾਡੀ ਮਜਬੂਰੀ ਅਸੀਂ ਸਮਝਦੇ ਹਾਂ ਜੀ ਪਰ ਸਾਡੀ ਵੀ ਮਜਬੂਰੀ ਹੈਗੀ ਹੈ ਸਰ ਅਸੀਂ ਪਹਿਲਾਂ ਕੰਮ ਲਿਆ ਹੋਇਆ ਉਹਨੂੰ ਵਿਚਾਲੇ ਨਹੀਂ ਛੱਡ ਸਕਦੇ ਕਿਉਂਕਿ ਇਨ੍ਹਾਂ ਦੇ ਅੱਗੇ ਵਿਆਹ ਦਾ ਕੰਮ ਹੈਗਾ ਜਿਨ੍ਹਾਂ ਦੇ ਅਸੀਂ ਕੰਮ ਲੱਗੇ ਨਾ ਸਰ ਅਤੇ ਇਨ੍ਹਾਂ ਦੇ ਵਿਆਹ ਦਾ ਕੰਮ ਹੈਗਾ ਦੋ ਦਿਨ ਬਾਅਦ ਬਰਾਤ ਆਉਣੀ ਹੈ ਕੁੜੀ ਦਾ ਵਿਆਹ ਹੈ ਜੀ ਤਾਂ ਇਨ੍ਹਾਂ ਨੂੰ ਪੂਰਾ ਕੰਮ ਕੰਪਲੀਟ ਕਰਕੇ ਅਸੀਂ ਦੇਣਾ ਸਰ ਅਤੇ ਉਹਦੇ ਵਿੱਚੋਂ ਹੀ ਸਰ ਅਸੀਂ ਜੇ ਰਾਤ ਨੂੰ ਟੈਮ ਨਿਕਲਿਆ ਤਾਂ ਰਾਤ ਨੂੰ ਨਿਕਾਲਾਂਗੇ ਜਾਂ ਤੜਕੇ ਸਵੇਰੇ ਸਵੇਰੇ ਕਰ ਦਾਂਗੇ ਸਰ ਨਹੀਂ ਨਹੀਂ ਸਰ ਸਾਡਾ ਸਾਡਾ ਸਾਰਾ ਸਟਾਫ ਉੱਥੇ ਲੱਗਿਆ ਹੋਇਆ ਸਰ ਅਸੀਂ ਚਾਰ ਬ ਬੰਦੇ ਹੈਗੇ ਹਾਂ ਚਾਰੋਂ ਇਕੱਠੇ ਲੱਗੇ ਹੋਏ ਹਾਂ ਸਰ ਸਰ ਜਾਣਕਰੀ ਦੀ ਤੁਹਾਨੂੰ ਹੋਰ ਕਿਸੇ ਕਿਤੇ ਜਾਣ ਦੀ ਲੋੜ ਹੀ ਨਹੀਂ ਸਰ ਅਸੀਂ ਸ਼ਾਮ ਨੂੰ ਆ ਕੇ ਆਪੇ ਕਰ ਦਾਂਗੇ ਸਰ ਅਸੀਂ ਚਾਰ ਬੰਦੇ ਹੈਗੇ ਹਾਂ ਚਾਰੋਂ ਦੇ ਚਾਰੇ ਆ ਜਾਂਗੇ ਸਰ ਅਤੇ ਜਿੰਨੀਆਂ ਵੀ ਪਾਈਪਾਂ ਲੀਕੇਜ ਹੈਗੀਆਂ ਉਹ ਤੁਸੀਂ ਐਂਅ ਕਰੋ ਸਰ ਜਿਹੜੇ ਜਿਹੜੇ ਜੋੜ ਤੁਹਾਨੂੰ ਲੱਗਦੇ ਵੀ ਲੀਕ ਹੈਗੇ ਹੈ ਉਹ ਜੋੜ ਸਾਰੇ ਮੰਗਵਾ ਕੇ ਰੱਖ ਲਓ ਜਿਹੜੀ ਪਾਈਪ ਲੀਕ ਤੁਹਾਨੂੰ ਲੱਗਦੀ ਹੈ ਉਹ ਪੀਪ ਪਾਈਪ ਮੰਗਵਾ ਕੇ ਰੱਖ ਰੱਖ ਲਓ ਠੀਕ ਹੈ ਸਰ ਅਸੀਂ ਜਦੋਂ ਆਵਾਂਗੇ ਆ ਕੇ ਸਾਰੀ ਚੇਂਜ ਕਰ ਦਾਂਗੇ ਸਰ ਹਾਂਜੀ ਹਾਂਜੀ ਸਮਾਨ ਹਾਂਜੀ ਹਾਂਜੀ ਹਾਂਜੀ ਸਰ ਆਪਣੀ ਗੁਪਤਾ ਸ਼ੋਪ ਤੋਂ ਆ ਕੇ ਤੁਸੀਂ ਲੈ ਸਕਦੇ ਹੋ ਸਰ ਸਾਰਾ ਸਮਾਨ ਸਾਡੇ ਕੋਲ ਆ ਕੇ ਸਾਡੀ ਆਪਣੀ ਦੁਕਾਨ 'ਤੇ ਹੈਗਾ ਸਰ ਸਰ ਉਹ ਸਾਡੇ ਗੁਰੂ ਜੀ ਹੈਗੇ ਹੈ ਸਰ ਦੁਕਾਨ 'ਤੇ ਉਹ ਤੁਹਾਨੂੰ ਸਜਾ ਸਾਰਾ ਸਮਾਨ ਅਵੇਲੇਬਲ ਕਰਵਾ ਦੇਣਗੇ ਸਰ ਜਾਂ ਸਰ ਤੁਸੀਂ ਮੈਨੂੰ ਲਿਸਟ ਭੇਜ ਦਿਓ ਕਿਹੜਾ ਕਿਹੜਾ ਸਮਾਨ ਲੈ ਕੇ ਆਉਣਾ ਮੈਂ ਆਪਣੇ ਆਪ ਨਾਲ ਲੈ ਆਵਾਂਗਾ ਸਰ ਹਾਂਜੀ ਚਲੋ ਓ ਉਹ ਹਾਂ ਇਹ ਹੋ ਸਕਦਾ ਸਰ ਮੈਂ ਆਪਣਾ ਇੱਕ ਬੰਦਾ ਭੇਜ ਦਿੰਦਾ ਤੁਹਾਡੇ ਘਰ ਤੁਸੀਂ ਆਪਣਾ ਐਡਰੈਸ ਦੱਸ ਦਿਓ ਉੱਥੇ ਆ ਕੇ ਸਾਰਾ ਜਾਇਜਾ ਲੈ ਕੇ ਜਿੰਨਾ ਵੀ ਮਤਲਬ ਸਾਰਾ ਕੁਛ ਹੀ ਚੈਂਜ ਕਰਨ ਵਾਲਾ ਹੋਇਆ ਉਹ ਆਪੇ ਆ ਲਿਖ ਕੇ ਲੈ ਆਊਗਾ ਅਤੇ ਅਸੀਂ ਸ਼ਾਮ ਨੂੰ ਚੇਂਜ ਕਰ ਦਾਂਗੇ ਸਰ ਹਾਂਜੀ ਹਾਂਜੀ ਤੁਸੀਂ ਹਾਂਜੀ ਹਾਂਜੀ ਇਹ ਮੇਰਾ ਵਟਸਐਪ ਨੰਬਰ ਹੈ ਤੁਸੀਂ ਆਪਣਾ ਐਡਰੈਸ ਸੈਂਡ ਕਰ ਦਿਓ ਅਸੀਂ ਸਾਰਾ ਕੁਝ ਸਮਾਨ ਲਿਖ ਕੇ ਲੈ ਜਾਂਗੇ ਸ਼ਾਮ ਨੂੰ ਜਾਂ ਤ ਤੜਕੇ ਸਵੇਰੇ ਟੈਮ ਨਾਲ ਚੇਂਜ ਕਰ ਦਾਂਗੇ ਸਰ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਥੈਂਕਿਊ ਥੈਂਕਿਊ